ਮੈਨੂੰ ਬਚਪਨ ਤੋਂ ਹੀ ਡਰਾਇੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਪੰਜਵੇਂ ਵਿੱਚ ਇੱਕ ਆਟ ਦੇ ਰੂਪ ਵਿੱਚ ਇੱਕ ਘੋੜੇ ਦੀ ਸ਼ੇਪ ਬਣਾਈ ਸੀ ਅਤੇ ਜਿਸ ਨੂੰ ਦੇਖ ਕੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਅਤੇ ਦਸਵੀ ਵ ਅੱਠਵੀਂ ਵਿੱਚ ਮੈਂ ਇੱਕ ਇੱਕ ਬ ਬੰਦੇ ਮੈਨ ਦੀ ਸ਼ੇਪ ਬਣਾਈ ਸੀ ਜੋ ਦੇਖਣ ਵਿੱਚ ਬਹੁਤ ਹੀ ਵਧੀਆ ਲੱਗਦੀ ਸੀ ਅਤੇ ਦਸਵੀਂ ਵਿੱਚ ਦਸਵੀਂ ਵਿੱਚ ਇੱਕ ਮੈਂ ਇੱਕ ਸੈ ਸੀਨਰੀ ਬਣਾਈ ਸੀ ਜੋ ਦੇਖਣ ਵਿੱਚ ਬਹੁਤ ਜ਼ਿਆਦਾ ਹੀ ਅਲੱਗ ਸੀ ਸਿੰ ਚਿੱਤਰਕਾਰੀ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਇੱਕ ਸ਼ਾਂਤ ਮਨ ਨਾਲ਼ ਬਣਾ ਸਕਦੇ ਹਾਂ ਅਤੇ ਇਹ ਇਸ ਨੂੰ ਸ਼ੋਰ ਸ਼ਰਾਬੇ ਤੋਂ ਦੂਰ ਹੋ ਕੇ ਵਧੀਆ ਤਰੀਕੇ ਨਾਲ਼ ਸ਼ਾਂਤ ਮਨ ਨਾਲ਼ ਬਣਾਇਆ ਜਾ ਸਕਦਾ ਹੈ ਇਹ ਇੱਕ ਅਜਿਹਾ ਹੁਨਰ ਹੈ ਸਾਨੂੰ ਇੱਕ ਵੱਖਰਾ ਸਰੂਪ ਦਿੰਦਾ ਹੈ ਅਤੇ ਮੈਂ ਇੱਕ ਕਲ ਮੈਂ ਇਕ ਇਸਨੂੰ ਬਹੁਤ ਮੇਰੇ ਕੋਲੋਂ ਚਿੱਤਰਕਾਰੀ ਸਿੱਖਣ ਲਈ ਬਹੁਤ ਜਾਣੇ ਆਏ ਸਨ ਜੋ ਜਿਨ੍ਹਾਂ ਨੇ ਜੋ ਇਸ ਚਿੱਤਰਕਾਰੀ ਨੂੰ ਸਿੱਖ ਕੇ ਮੇਰੇ ਕੋਲੋਂ ਬਹੁਤ ਜ਼ਿਆਦਾ ਖੁਸ਼ ਹੋਏ ਸਨ ਅਤੇ ਉਹਨਾਂ ਨੇ ਮੈਨੂੰ ਕੋਈ ਕੋਈ ਵੱਡੀ ਸੰਸਥਾ ਖੋਲਣ ਦੀ ਲਈ ਕਿਹਾ ਹੈ